ਮੋਹਾਲੀ ਜ਼ਿਲ੍ਹੇ ਵਿੱਚ ਮੁੱਖ ਸੱਭਿਆਚਾਰਕ ਤਿਉਹਾਰ ਮਨਾਏ ਜਾਂਦੇ ਹਨ ਜਿਹਨਾਂ ਵਿੱਚ ਦੀਵਾਲੀ ਅਤੇ ਲੋਹੜੀ ਔਰ ਹੋਲੀ ਮ ਮੁੱਖ ਤੌਰ 'ਤੇ ਹਨ ਉਹਨਾਂ ਵਿੱਚੋਂ ਸਾਰੇ ਤਿਉਹਾਰਾਂ ਵਿੱਚ ਪੁਰਾਣੀਆਂ ਚੱਲ ਰਹੀਆਂ ਪ ਪਰੰਪਰਾਵਾਂ ਨੂੰ ਚੰਗੀ ਤਰ੍ਹਾਂ ਇੱਕ ਤਰੀਕੇ ਨਾਲ਼ ਨਿਭਾਇਆ ਜਾਂਦਾ ਹੈ ਜੀ ਪਹਿਲਾਂ ਤੋਂ ਚੱਲਦੇ ਰੀਤੀ ਰਿਵਾਜਾਂ ਮੁਤਾਬਿਕ ਹੀ ਸਾਡੇ ਵਡੇਰਿਆਂ ਨੂੰ ਵੀ ਪੂਜਿਆ ਜਾਂਦਾ ਹੈ ਜਿਸ ਵਿੱਚ ਲਕਛਮੀ ਮਾਤਾ ਦੀ ਪੂਜਾ ਵੀ ਹੁੰਦੀ ਹੈ ਅਤੇ ਇਸ ਵਿੱਚ ਇਸ ਦਿਨ ਸਕ ਸਾਰੇ ਜੋ ਲੋਕ ਹੈ ਆਪਣੇ ਘਰਾਂ ਤੋਂ ਬਿਲਕੁਲ ਤਿਆਰ ਬਰ ਤਿਆਰ ਹੋ ਕੇ ਮੱਥਾ ਟੇਕਣ ਵੀ ਜਾਣ ਮ ਮੱਥਾ ਟੇਕਣ ਜਾਂਦੇ ਹਨ ਅਤੇ ਇਹਨਾਂ ਤੋਂ ਇਲਾਵਾ ਰਾਤ ਨੂੰ ਬੱਚਿਆਂ ਲਈ ਪਟਾਖੇ ਅਤੇ ਮਿਠਾਈਆਂ ਵਗੈਰਾ ਦਾ ਵੀ ਯੋਗ ਪ੍ਰਬੰਧ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੀ ਹੋਲੀ ਹੈਗੀ ਹੈ ਹੋਲੀ ਅੱਜ ਤੋਂ ਕਾਫ਼ੀ ਸਾਲ ਪਹਿ ਕਾਫ਼ੀ ਵਰਿਆਂ ਤੋਂ ਪਰਮ ਪਰਮ ਤਰੀਕੇ ਨਾਲ਼ ਮਨਾਈ ਜਾ ਰਹੀ ਹੈ